ਹੈਲੋ ਮੈਂ ਅੰਜਲੀ ਮੈਂ ਤੁਹਾਡੇ ਤੋਂ ਕੱਲ੍ਹ ਹੈੱਡਫੋਨ ਮੰਗਾਏ ਸੀ ਉਹ ਬੜੇ ਹੀ ਖ਼ਰਾਬ ਨਿਕਲੇ ਅਤੇ ਨਾਲ਼ੇ ਡੱਬਾ ਵੀ ਫਟਿਆ ਹੋਇਆ ਪਿਆ ਸੀ ਪੈਕਿੰਗ ਵੀ ਬਹੁਤ ਵਧੀਆ ਵੀ ਨਹੀਂ ਕੀਤੀ ਹੋਈ ਸੀ ਉਹ ਮੈਂ ਤਾਂ ਨਾਲ਼ੇ ਚਿੱਟੇ ਰੰਗ ਦੇ ਮੰਗਾਏ ਹੋਏ ਸੀ ਹੈੱਡਫੋਨ ਅਤੇ ਤੁਸੀਂ ਕਾਲੇ ਰੰਗ ਦੇ ਲਿਆ ਤੇ ਮੇਰੇ ਘਰਦਿਆਂ ਅਤੇ ਮੇਰੀ ਸਹੇਲੀਆਂ ਨੇ ਮੇਰੀ ਬਹੁਤ ਬੇਇਜ਼ਤੀ ਕੀਤੀ ਮੇਰੇ ਘਰਦਿਆਂ ਨੇ ਵੀ ਮੈਨੂੰ ਬਹੁਤ ਏ ਬੋਲਿਆ ਤੁਸੀਂ ਇੰਨੇ ਮਹਿੰਗੇ ਮੰਗਾ ਤਾਂ ਲਏ ਕੀ ਖਰੇ ਵੀ ਨਹੀਂ ਨਿਕਲੇ ਉਹਦੇ ਵਿੱਚ ਆਵਾਜ਼ ਤਾਂ ਆਉਂਦੀ ਹੈ ਪਰ ਫਟ ਫਟ ਕੇ ਆਵਾਜ਼ ਆਉਂਦੀ ਹੈ ਮੈਂ ਸ਼ਿਕਾਇਤ ਤਾਂ ਦਰਜ ਕੀਤੀ ਹੈ ਹੁਣ ਦੇਖੋ ਕੀ ਹੁੰਦਾ ਹੈ ਧੰਨਵਾਦ